ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਫੋਟੋਗ੍ਰਾਫੀ ਦੀ ਫੋਟੋਗ੍ਰਾਫੀ ਮੇਰਾ ਇੱਕ ਪੈਸ਼ਨ ਹੈ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਂ ਫੋਟੋਆਂ ਖਿੱਚਣੀਆਂ ਅਤੇ ਹਰ ਚੀਜ਼ ਨੂੰ ਆਪਣੇ ਕੈਮਰੇ ਨੂੰ ਵਿੱਚ ਕੈਦ ਕਰਨ ਨੂੰ ਇੱਕ ਆਪਣੇ ਮਨ ਦੀ ਸੰਤੁਸ਼ਟੀ ਮੰਨਦਾ ਹਾਂ ਅਤੇ ਹੁਣ ਜੇ ਆਪਾਂ ਗੱਲ ਕਰੀਏ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੀ ਹਾਂ ਮੈਂ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦਾ ਪ੍ਰਯੋਗ ਕੀਤਾ ਹੈ ਅਤੇ ਕਈ ਵਾਰ ਮੈਂ ਫੋਟੋਆਂ ਬਲੈਕ ਐਂਡ ਵਾਈਟ ਵੀ ਖਿੱਚੀਆਂ ਹਨ ਬਲੈਕ ਐਂਡ ਵਾਈਟ ਫੋਟੋ ਦੀ ਇੱਕ ਅਲੱਗ ਗਰੇਸ ਇੱਕ ਅਲੱਗ ਸ਼ੋਭਾ ਹੁੰਦੀ ਹੈ ਜਿਵੇਂ ਆਪਾਂ ਗੱਲ ਕਰੀਏ ਫੋਟੋਗ੍ਰਾਫੀ ਦੀ ਜਦੋਂ ਆਪਾਂ ਬਹੁਤ ਜ਼ਿਆਦਾ ਰੰਗ ਬਿਰੰਗੇ ਕਲਰ ਦੇਖ ਕੇ ਅੱਕ ਚੁੱਕੇ ਹੁੰਦੇ ਆ ਤਾਂ ਆਪਾਂ ਨੂੰ ਬਲੈਕ ਐਂਡ ਵਾਈਟ ਫੋਟੋ ਇੱਕ ਅਲੱਗ ਹੀ ਨਜ਼ਾਰਾ ਦਿੰਦੀ ਹੈ ਜੇ ਆਪਾਂ ਗੱਲ ਕਰੀਏ ਮੋਨੋਕ੍ਰੋਮੈਟਿਕ ਚਿੱਤਰਾਂ ਦੀ ਮੋਨੋਕ੍ਰੋਮੈਟਿਕ ਚਿੱਤਰ ਬਾਰੇ ਵੀ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਮੋਨੋਕ੍ਰੋਮੈਟਿਕ ਚਿੱਤਰ ਕਦੇ ਕਦੇ ਜ਼ਿਆਦਾ ਸੋਹਣੇ ਇਸ ਲਈ ਲੱਗਦੇ ਹਨ ਕਿਉਂਕਿ ਆਪਾਂ ਰੰਗਾਂ 'ਚ ਰੰਗਾਂ ਨੂੰ ਬਾਰ ਬਾਰ ਦੇਖਦੇ ਉਹਨਾਂ ਤੋਂ ਅੱਕ ਚੁੱਕੇ ਹੁੰਦੇ ਹਾਂ ਅਤੇ ਆਪਾਂ ਕੁਝ ਅਲੱਗ ਦੇਖਣਾ ਚਾਹੁੰਦੇ ਹਾਂ ਅਤੇ ਉਹ ਅਲੱਗ ਹੈ ਮੋਨੋਕ੍ਰੋਮੈਟਿਕ ਚਿੱਤਰ ਕਿਉਂਕਿ ਮੋਨੋਕ੍ਰੋਮੈਟਿਕ ਚਿੱਤਰ ਇੱਕ ਸਿੰਪਲ ਅਤੇ ਸੋਬਰ ਹੈ ਜੋ ਕਿ ਪੁਰਾਣੇ ਜ਼ਮਾਨੇ ਵਿੱਚ ਵਰਤੇ ਜਾਂਦੇ ਸਨ ਕਦੇ ਕਦੇ ਆਪਣੇ ਆਪ ਨੂੰ ਪੁਰਾਣੇ ਸਮੇਂ ਲਈ ਜੋੜਨ ਲਈ ਪੁਰਾਣੇ ਸਮੇਂ ਦੇ ਨਾਲ ਜੋੜਨ ਲਈ ਵੀ ਅਸੀਂ ਮੋਨੋਕ੍ਰੋਮੈਟਿਕ ਫੋਟੋਗ੍ਰਾਫੀ ਦਾ ਵਰਤੋਂ ਕਰਦੇ ਹਾਂ ਹੁਣ ਮੋਨੋਕ੍ਰੋਮੈਟਿਕ ਫੋਟੋ ਜੋ ਕਿ ਇੱਕੋ ਹੀ ਰੰਗ ਵਿੱਚ ਹੁੰਦੀ ਹੈ ਜਿਸ ਨੂੰ ਅਸੀਂ ਬਲੈਕ ਐਂਡ ਵਾਈਟ ਫੋਟੋ ਵੀ ਕਹਿੰਦੇ ਹਾਂ ਧੰਨਵਾਦ